ਖੇਡਾਂ ਖੇਡਣ ਦੇ ਵਿੱਚ ਚਾਹੇ ਉਹ ਮੋਬਾਈਲ 'ਤੇ ਹੋਣ ਜਾਂ ਫਿਰ ਗਰਾਊਂਡ ਦੇ ਵਿੱਚ ਹੋਣ ਪੇਂਡੂ ਲੋਕਾਂ ਦੀ ਜਿਹੜੀ ਰਾਇ ਹੈ ਜਿਹੜੀ ਸੋਚ ਹੈ ਓਹ ਹਮੇਸ਼ਾ ਤੋਂ ਹੀ ਖੇਡਾਂ ਦੇ ਨਾਲ ਰਹੀ ਹੈ ਉਹ ਖੇਡਾਂ ਖੇਡਦੇ ਹਨ ਕਬੱਡੀ ਇੱਕ ਬਹੁਤ ਲੋਕ ਪ੍ਰਸਿੱਧ ਖੇਡ ਹੈ ਜਿਹੜੀ ਕਿ ਪਿੰਡਾਂ ਦੇ ਵਿੱਚ ਬਹੁਤ ਮਸ਼ਹੂਰ ਹੈ ਜਿਹੜੀ ਲੋਕਾਂ ਨੂੰ ਬਹੁਤ ਖੇਡਣੀ ਪਸੰਦ ਹੈ ਕ੍ਰਿਕਟ ਬੈੱਡਮਿੰਟਨ ਫੁੱਟਬਾਲ ਇਹ ਸਾਰੀ ਖੇਡਾਂ ਪਿੰਡਾਂ ਦੇ ਲੋਕ ਬਹੁਤ ਖੇਡਦੇ ਰਹਿੰਦੇ ਹਨ ਕੁਸ਼ਤੀ ਵੀ ਬਹੁਤ ਖੇਡਦੇ ਹਨ ਲੋਕ ਪਿੰਡਾਂ ਦੇ ਅਤੇ ਓਵਰਆਲ ਜੇ ਅਸੀਂ ਗੱਲ ਕਰੀਏ ਪਿੰਡਾਂ ਦੇ ਵਿੱਚ ਖੇਡਾਂ ਬਾਰੇ ਬਹੁਤ ਹੀ ਚੰਗੇ ਵਿਚਾਰ ਹਨ ਅਤੇ ਪਿੰਡਾਂ ਦੇ ਵਿੱਚ ਆਪਣੇ ਜਵਾਕਾਂ ਨੂੰ ਆਪਣੇ ਲੋਕਾਂ ਨੂੰ ਖੇਡਾਂ ਖੇਡਣ ਦੇ ਲਈ ਉਤਸ਼ਾਹਿਤ ਕਰਿਆ ਜਾਂਦਾ ਹੈ ਅਤੇ ਇਸੇ ਦੇ ਨਾਲ ਨਾਲ ਇਹ ਜਿਹੜਾ ਪ੍ਰਭਾਵ ਹੈ ਉਹ ਸ਼ਹਿਰਾਂ ਦੇ ਵਿੱਚ ਵੀ ਆਉਣ ਲੱਗਿਆ ਹੈ ਜਿਸ ਕਰਕੇ ਓਵਰਆਲ ਜਿਹੜੀ ਲੋਕਾਂ ਦੀ ਜਿਹੜੀ ਸਿਹਤ ਹੈ ਉਹਨਾਂ ਦੇ ਵਿੱਚ ਵੀ ਬਹੁਤ ਪ੍ਰਭਾਵ ਪਿਆ ਹੈ ਅਤੇ ਉਹ ਤੰਦਰੁਸਤ ਹੋਏ ਹਨ